ਮੈਂ ਬਲਕਾਰ ਸਿੰਘ ਸੈਂਟਰਲ ਯੂਨੀਵਰਸਿਟੀ ਵਿੱਚ ਪੀ ਐਚ ਡੀ ਕਰ ਰਿਹਾ ਮੈਂ ਆਪਣੇ ਕੋਜ ਵਰਕ ਨਾਲ ਸੰਬੰਧਿਤ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਕਿਤਾਬ ਮੰਗਵਾਈ ਸੀ ਉਹ ਕਿਤਾਬ ਸੀ ਰਾਗ ਦਰਬਾਰੀ ਰਾਗ ਦਰਬਾਰੀ ਜੋ ਸ਼੍ਰੀ ਲਾਲ ਸ਼ੁਕਲ ਦਾ ਨਾਵਲ ਹੈ ਉਹ ਚੇਤਨਾ ਪ੍ਰਕਾਸ਼ਨ ਤੋਂ ਛਪਿਆ ਹੈ ਅਤੇ ਪ੍ਰੀਤਮ ਸਿੰਘ ਦੁਆਰਾ ਅਨੁਵਾਦ ਕੀਤਾ ਗਿਆ ਹੈ ਉਸ ਦਾ ਅਨੁਵਾਦ ਬਹੁਤ ਵਧੀਆ ਅਤੇ ਉਸ ਕਿਤਾਬ ਲਈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਇੱਕ ਤਾਂ ਉਹ ਕਿਤਾਬ ਪੂਰੇ ਸਮੇਂ 'ਤੇ ਪਹੁੰਚ ਗਈ ਦੂਜਾ ਉਸ ਕਿਤਾਬ ਦਾ ਪੇਪਰ ਬਹੁਤ ਵਧੀਆ ਲੱਗਿਆ ਹੈ ਜਿਸ ਨੂੰ ਪੜ੍ਹਨ ਦੇ ਵਿੱਚ ਬੜੀ ਆਸਾਨੀ ਹੁੰਦੀ ਹੈ ਅਸੀਂ ਤਾਂ ਅ ਅਕਸਰ ਦੇਖਦੇ ਹਾਂ ਕਿ ਜਿਹੜਾ ਪੇਪਰ ਹੁੰਦਾ ਉਹ ਪੀਲੇ ਰੰਗ ਦਾ ਬੜਾ ਰੱਦੀ ਟਾਈਪ ਲਗਾ ਦਿੱਤਾ ਜਾਂਦਾ ਇੱਕ ਤਾਂ ਆਪਣਾ ਪ੍ਰੋਫਿਟ ਕਮਾਉਣ ਲਈ ਪਰ ਤੁਸੀਂ ਕਿਤਾਬ ਦਾ ਪੇਜ ਆ ਬੜਾ ਵਧੀਆ ਲਗਾਇਆ ਮੈਨੂੰ ਉਹ ਕਿਤਾਬ ਬਹੁਤ ਵਧੀਆ ਲੱਗੀ ਅਤੇ ਮੈਂ ਸਭ ਨੂੰ ਅੱਗੇ ਤੋਂ ਵੀ ਕਿਤਾਬਾਂ ਖਰੀਦਣ ਲਈ ਤੁਹਾਡੇ ਅਡ੍ਰੈਸ ਦਾ ਹੀ ਹਵਾਲਾ ਦਿੰਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਂ ਹਮੇਸ਼ਾ ਮੇਰੀ ਇਸ ਤਰੀਕੇ ਨਾਲ ਮਦਦ ਕਰਦੇ ਰਹੋ ਅਤੇ ਮੈਂ ਵੀ ਤੁਹਾਡੇ ਤੋਂ ਹਮੇਸ਼ਾ ਕਿਤਾਬਾਂ ਖਰੀਦਦਾ ਰਹਾਂ